ਖੇਡਣ ਦਾ ਮੈਨੂੰ ਬਚਪਨ ਤੋਂ ਹੀ ਬਹੁਤ ਸ਼ੌਂਕ ਸੀਗਾ ਅਤੇ ਸਕੂਲ ਵਿੱਚ ਖੇਡਦੇ ਰਹਿੰਦੇ ਹੁੰਦੇ ਸੀਗੇ ਬਸ ਜਿਵੇਂ ਕੋਈ ਲੰਗੜਾ ਸ਼ੇਰ ਹੋ ਗਿਆ ਹੋਰ ਖੇਡਾਂ ਹੋ ਗਈਆਂ ਚਲਦੀਆਂ ਰਹਿੰਦੀਆਂ ਸੀਗੀਆਂ ਹੌਲੀ ਹੌਲੀ ਅਗਾਂਹ ਸਕੂਲਾਂ ਦੇ ਵਿੱਚ ਕੰਪਟੀਸ਼ਨ ਕਰਨ ਲੱਗ ਗਏ ਮਾੜਾ ਮੋਟਾ ਦੌੜਨ ਲੱਗ ਗਏ ਅਤੇ ਉੱਦੋਂ ਬਾਅਦ ਇੱਕ ਵਾਰੀ ਸਾਡੇ ਸਕੂਲ 'ਚ ਸਾਨੂੰ ਯਾਦ ਆ ਸਾਡੇ ਸਕੂਲ 'ਚ ਖੋ ਖੋ ਚੱਲਦੀ ਸੀ ਖੇ ਖੋ ਖੋ 'ਚ ਵੀ ਭੱਜਣ ਵਗੈਰਾ ਅਤੇ ਚੱਲਣਾ ਪੈਂਦਾ ਸੀਗਾ ਉਹ ਵਧੀਆ ਗੇਮ ਸੀ ਸਾਡੀ ਫਿਰ ਸਾਡੇ ਕਹਿੰਦੇ ਕਿ ਚਲੋ ਅਥਲੀਟ ਦਾ ਰੇਸਾਂ ਰੂਸਾਂ ਲਾਉਣੀਆਂ ਸ਼ੁਰੂ ਕਰੋ ਸਾਰੇ ਅਸੀਂ ਜਾਣੀ ਕਾਫ਼ੀ ਗਰੁੱਪ ਸੀਗਾ ਭੱਜਣਾ ਸ਼ੁਰੂ ਹੋਏ ਪਹਿਲਾਂ ਤਾਂ ਮੈਨੂੰ ਡਰ ਜਿਹਾ ਲੱਗਿਆ ਮੈਂ ਕਿਹਾ ਯਾਰ ਕਿੱਥੇ ਲਾਈਨਾਂ 'ਚ ਲਾਵਾਂਗੇ ਅਤੇ ਰੇਸ ਲਗਾਵਾਂਗੇ ਕਿਉਂਕਿ ਉਹ ਸਟੈਪਿੰਗ ਕਰਨੀ ਪੈਂਦੀ ਆ ਅਤੇ ਸਿੱਧਾ ਭੱਜਣਾ ਪੈਂਦਾ ਲਾਈਨਾਂ ਲੱਗੀਆਂ ਹੁੰਦੀਆਂ ਨੇ ਬੜੀ ਘਬਰਾਹਟ ਜਿਹੀ ਹੋਈ ਮਨ ਜਿਹੇ 'ਚ ਇੱਕ ਚਲੋ ਸ਼ੰਕਾ ਕਰਦੇ ਕਰਦੇ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਅਤੇ ਜਦੋਂ ਪੰਦਰਾਂ ਵੀਹ ਮੁੰਡੇ ਅਸੀਂ ਭੱਜ ਰਹੇ ਸੀ ਇਕੱਠੇ ਹੋ ਕੇ ਸਾਰੇ ਅਤੇ ਮੈਂ ਮੈਂ ਥੋੜ੍ਹਾ ਜਿਹਾ ਪਿੱਛੇ ਰਹਿ ਗਿਆ ਤਾਂ ਮੈਂ ਥੋੜ੍ਹਾ ਜਿਹਾ ਅੱਗੇ ਹੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਉਹ ਕਿਸੇ ਨਾਲ ਦੇ ਨਾਲ ਲੱਗ ਗਿਆ ਅਤੇ ਮੈਂ ਥੜੰਮ ਦੇਣੇ ਥੱਲੇ ਡਿੱਗ ਪਿਆ ਬਹੁਤ ਬੁਰੀ ਤਰ੍ਹਾਂ ਚੱਕਰ ਖਾ ਗਿਆ ਐਂ ਕਰਕੇ ਅਤੇ ਪਹਿਲਾਂ ਤਾਂ ਮੈਨੂੰ ਲੱਗਿਆ ਕਿ ਮੈਂ ਕਿਹਾ ਯਾਰ ਛੱਡ ਦਿੰਦੇ ਹਾਂ ਮੈਂ ਕਿਹਾ ਚਲੋ ਰੇਸ ਕੀ ਛੱਡਣੀ ਆਪਾਂ ਇੱਕ ਵਾਰੀ ਚਲੋ ਭੱਜਿਓ ਤਾਂ ਸਹੀ ਅਤੇ ਮੈਂ ਭੱਜਦਾ ਭੱਜਦਾ ਗਿਆ ਮਤਲਬ ਅੱਠ ਸੌ ਮੀਟਰ ਦੀ ਰੇਸ ਸੀ ਸਾਡੀ ਉਹ ਅਤੇ ਦੂਜਾ ਗੇੜਾ ਸੀਗਾ ਦੂਜਾ ਗੇੜਾ ਕਰਦਾ ਕਰਾਉਂਦਾ ਮੈਂ ਫਿਰ ਵੀ ਆਪਦੀ ਹਿੰਮਤ ਜਿਹੀ ਕਰਕੇ ਤੀਜੇ ਨੰਬਰ 'ਤੇ ਉਹਦੇ 'ਚ ਆ ਗਿਆ ਅਤੇ ਸਾਨੂੰ ਮੈਨੂੰ ਵੀ ਸਾਰੇ ਸਾਡੇ ਟੀਚਰਾਂ ਨੇ ਅਤੇ ਕੋਚ ਸਾਹਿਬ ਨੇ ਬੜਾ ਉਹ ਐਪਰੀਸ਼ੀਏਟ ਕੀਤਾ ਕਿ ਭਾਈ ਤੂੰ ਤਾਂ ਬਹੁਤ ਵਧੀਆ ਡਿੱਗਦਾ ਅਤੇ ਤੇਰੇ ਸੱਟ ਵੀ ਵੱਜ ਗਈ ਨਾਲੇ ਮੇਰੇ ਇੱਥੇ ਗੋਡੇ 'ਤੇ ਸੱਟ ਵੱਜ ਗਈ ਖੂਨ ਨਿਕਲਣ ਲੱਗ ਗਿਆ ਉਹ ਕਹਿੰਦੇ ਕੋਈ ਨਹੀਂ ਕੋਈ ਨਹੀਂ ਉਹਨਾਂ ਨੇ ਮਾੜੀ ਮੋਟੀ ਇੱਕਦਮ ਉੱਥੇ ਖੂਨ ਜਿਹਾ ਝਾੜ ਕੇ ਪੱਟੀ ਪੁੱਟੀ ਕਰਤੀ ਅਤੇ ਮੇਰੇ ਕਾਫ਼ੀ ਦੋ ਚਾਰ ਦਿਨ ਤਾਂ ਮੇਰੇ ਬਹੁਤ ਦਰਦ ਕਰਦਾ ਰਿਹਾ ਮੈਂ ਛੱਡਤਾ ਮੈਂ ਕਿੱਥੇ ਯਾਰ ਇਹ ਜਿਹਾ ਪੰਗਾ ਲੈ ਲਿਆ ਆਪਾਂ ਪਰ ਉਸ ਤੋਂ ਬਾਅਦ ਮੈਂ ਫਿਰ ਆਪਣਾ ਨਿੰਮ ਨਾਲ ਟਕੋਰ ਕਰੀ ਉਸ 'ਤੇ ਲਗਾਈ ਆਪਣੇ ਆਪ ਦਵਾਈ ਲਗਾਈ ਦੇਸੀ ਲਗਾਈ ਅਤੇ ਜਿਸ ਨਾਲ ਮੈਨੂੰ ਬਹੁਤ ਫ਼ਰਕ ਪੈ ਗਿਆ ਉਸ ਤੋਂ ਬਾਅਦ ਮੈਂ ਵੀ ਮਨ 'ਚ ਸੋਚਿਆ ਕਿ ਯਾਰ ਜਦੋਂ ਆਪਾਂ ਖੇਡਾਂਗੇ ਭੱਜਾਂਗੇ ਦੌੜਾਂਗੇ ਕਿ ਸੱਟਾਂ ਦਾ ਵੱਜਦੀਆਂ ਹੀ ਰਹਿੰਦੀਆਂ ਨੇ ਵੀ ਉਸ ਤੋਂ ਬਾਅਦ ਮੇਰਾ ਮੈਂ ਹੋਰ ਰੇਸ ਲਗਾਉਣ ਲੱਗ ਗਿਆ ਜਿਸ 'ਚ ਮੇਰੀ ਦੂਜੀ ਪੁਜ਼ੀਸ਼ਨ ਆਈ ਫਸਟ ਵੀ ਆਈ ਹਾਂ ਜ਼ਰੂਰ ਆ ਕਿਉਂਕਿ ਗਿੱਟੇ ਗੁੱਟੇ ਦੁੱਖਣ ਲੱਗ ਜਾਂਦੇ ਆ ਉਹਦਾ ਇਹ ਹੀ ਹੱਲ ਆ ਕਿ ਐਕਸਰਸਾਈਜ਼ ਮੈਂ ਕਰਦਾ ਰਹਿੰਦਾ ਸੀ ਰੈਗੂਲਰ ਉੱਦੋਂ ਪਹਿਲਾਂ ਜਦੋਂ ਦੌੜ ਲਗਾਉਣੀ ਆ ਛੋਰ ਹੌਲੀ ਵਾਕਿੰਗ ਕਰਨੀ ਫਿਰ ਵਾਰਮਅੱਪ ਹੋਣਾ ਫਿਰ ਐਕਸਰਸਾਈਜ਼ ਕਰਨੀ ਉਸ ਦੇ ਤਜਰਬੇ ਨਾਲ ਮੈਨੂੰ ਬਹੁਤ ਠੀਕ ਲੱਗਿਆ ਸੱਟਾਂ ਤਾਂ ਮਾੜੀਆਂ ਮੋਟੀਆਂ ਵੱਜਦੀ ਰਹਿੰਦੀਆਂ ਜਿਹਨੂੰ ਹੁਣ ਪਰਵਾਹ ਕਰਨ ਦੀ ਲੋੜ ਨਹੀਂ ਜਿਹੜਾ ਪਰਵਾਹ ਕਰ ਜਾਂਦਾ ਉਹ ਤਾਂ ਫਿਰ ਅੱਗੇ ਵੱਧ ਨਹੀਂ ਸਕਦਾ